ਹਾਂਜੀ ਮੇਰੇ ਕੋਲ ਇੱਕ ਕਿਤਾਬ ਹੈ ਜਿਹਦੇ ਵਿੱਚ ਸੱਚੀਆਂ ਘਟਨਾਵਾਂ ਹਨ ਉਸ ਕਿਤਾਬ ਦਾ ਨਾਮ ਹੈ ਕਬ ਕਟੇਗੀ ਚੁਰਾਸੀ ਜਿਸ ਵਿੱਚ ਮੇ ਜਿਸ ਵਿੱਚ ਉੱਨੀ ਸੌ ਚੁਰਾਸੀ ਵਿੱਚ ਵਾਪਰੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਜੋ ਉੱਨੀ ਸੌ ਚੁਰਾਸੀ ਵਿੱਚ ਜੰਗ ਨੂੰ ਬਿਆਨ ਕੀਤਾ ਗਿਆ ਹੈ ਕਿਵੇਂ ਦਿੱਲੀ ਵਿੱਚ ਕਿਵੇਂ ਦਿੱਲੀ ਵਿੱਚ ਇੰਦਰਾ ਗਾਂਧੀ ਜੀ ਦਾ ਕਤਲ ਹੋਇਆ ਸੀ ਉਸ ਬਾਰੇ ਸਾਰਾ ਕੁਛ ਦੱਸਿਆ ਗਿਆ ਹੈ ਅਤੇ ਇਹ ਕਿਤਾਬ ਮੇਰੀ ਦਿਲਚਸਪ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਸ ਬਾਰ ਇਸ ਕਿਤਾਬ ਨੂੰ ਪੜ੍ਹ ਕੇ ਕਿਉਂਕਿ ਇਸ ਵਿੱਚ ਮੇਰਾ ਸਿੱਖੀ ਇਤਿਹਾਸ ਸਭ ਕੁਝ ਸੱਚ ਸੱਚ ਲਿਖਿਆ ਹੋਇਆ ਹੈ ਕਿਵੇਂ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ ਗਿਆ ਸੀ ਕਿਵੇਂ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਸਿੱਖਾਂ ਉੱਤੇ ਹਮਲਾ ਕੀਤਾ ਗਿਆ ਸੀ ਕਿੰਨੇ ਹੀ ਸ਼ਹੀਦ ਹੋਏ ਸੀ ਕਿੰਨੇ ਹੀ ਸਾਡੇ ਸਿੱਖ ਸ਼ਹੀਦ ਹੋਏ ਸਨ ਕਿਵੇਂ ਸਾਰਾ ਇਤਿਹਾਸ ਬਹੁਤ ਹੀ ਵਧੀਆ ਅਤੇ ਬਹੁਤ ਸਹੀ ਤਰੀਕੇ ਨਾਲ ਲਿਖਿਆ ਗਿਆ ਹੈ ਜੋ ਕਿ ਮੇਰਾ ਬਹੁਤ ਦਿਲਚਸਪ ਕਿਤਾਬ ਹੈ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਹ ਕਿਤਾਬ ਪੜ੍ਹ ਕੇ ਕਿਉਂਕਿ ਇਹ ਮੇਰੇ ਸਾਰੇ ਇਤਿਹਾਸ ਬਾਰੇ ਸੱਚ ਸੱਚ ਲਿਖਿਆ ਹੋਇਆ ਹੈ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਸ ਕਿਤਾਬ ਨੂੰ ਪੜ੍ਹ ਕੇ ਧੰਨਵਾਦ